ਕਾਨੂੰਨ ਪ੍ਰਣਾਲੀ ਦਾ ਨਿਰਮਾਣ ਕਰਨਾ ਵਿਧਾਨ ਮੰਡਲ ਦਾ ਕਾਰਜ ਹੈ ਪਰ ਕਈ ਵਾਰ ਵਿਧਾਨ ਮੰਡਲ ਦੁਆਰਾ ਕਾਨੂੰਨ ਅਸਪਸ਼ਟ ਵੀ ਹੁੰਦੇ ਹਨ ਅਤੇ ਉਹਨਾਂ ਦੀ ਸਪਸ਼ਟਤਾ ਨਿਆਂ ਪਾਲਿਕਾ ਕਰਦੀ ਹੈ ਅਤੇ ਨਿਆਏ ਦੀਸ਼ ਵਿੱਚ ਕਈ ਸਾਰੇ ਵਿਵਾਦ ਦਾ ਨਿਰਣੇ ਕਰਨਾ ਆਪਣੀ ਯੋਗਿਅਤਾ ਅਤੇ ਇਮਾਨਦਾਰੀ ਔਰ ਅਨੁਭਵਾਂ ਅਨੁਭਵਾਂ ਦੇ ਆਧਾਰ 'ਤੇ ਹੁੰਦਾ ਹੈ ਅਤੇ ਬਾਅਦ ਵਿੱਚ ਨਿ ਉ ਉਹਨਾਂ ਦਾ ਨਿਰਣਾ ਕਾਨੂੰਨ ਦਾ ਰੂਪ ਧਾਰਨ ਕਰ ਲੈਂਦੇ ਹਨ ਨਿਆਂ ਪਾਲਿਕਾ ਨਾਗਰਿਕਾਂ ਦੇ ਅਧਿਕਾਰਾਂ ਅਤੇ ਸੁਤੰਤਰਤਾ ਦੀ ਰੱਖਿਆ ਦਾ ਕਾਰਜ ਵੀ ਕਰਦੀ ਹੈ ਕਈ ਵਾਰ ਸਮਾਜ ਵਿਰੋਧੀ ਲੋਕ ਅਤੇ ਸਰਕਾਰਾਂ ਦਾ ਕੋਈ ਨਾਗਰਿਕਾਂ ਦੇ ਅਧਿਕਾਰਾਂ ਔਰ ਸੁਤੰਤਰਤਾ ਦੇ ਅਨੰਦ ਦਾ ਪ੍ਰਯਤਨ ਕਰਦਾ ਹੈ ਅਤੇ ਨਿਆਂ ਪਾਲਿਕਾ ਨਾਗਰਿਕਾਂ ਦੀ ਰੱਖਿਆ ਕਰਦਾ ਹੈ